ਹੈਲੋ ਰਾਮ ਰਾਮ ਭਾਅ ਜੀ ਕੀ ਹਾਲ ਚਾਲ ਹੋਰ ਕਿੱਥੇ ਸੀ ਮੈਂ ਘਰ ਹੋ ਕੇ ਆਇਆ ਤੁਹਾਡੇ ਕੋਲ ਤੁਸੀਂ ਘਰ ਨਹੀਂ ਹੈਗੇ ਠੀਕ ਹੈ ਠੀਕ ਹੈ ਭਾਅ ਜੀ ਹੋਰ ਖੇਤੀਬਾੜੀ ਠੀਕ ਚੱਲ ਰਹੀ ਹੈ ਹਾਂਜੀ ਹਾਂਜੀ ਉਹ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਕਿ ਨਵੀਂ ਟੈਕਨੋਲਜੀ ਆ ਗਈ ਕੋਈ ਗ੍ਰੀਨ ਰੈਵੋਲਿਊਸ਼ਨ ਕਰਕੇ ਅਤੇ ਉਹਦੇ ਬਾਰੇ ਕੁਛ ਪਤਾ ਤੁਹਾਨੂੰ ਹਾਂਜੀ ਉਹ ਮੈਂ ਕਿਹਾ ਉਹ ਯੂਜ਼ ਕਰਦੇ ਆ ਖਾਦਾਂ ਖੁਦਾ ਨਹੀਂ ਯੂਜ਼ ਕਰਨੀਆਂ ਚਾਹੀਦੀਆਂ ਜ਼ਿਆਦਾ ਅੱਜ ਕੱਲ੍ਹ ਬਿਮਾਰੀਆਂ ਬਹੁਤ ਆਉਣ ਦੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਜੀ ਬਿਲਕੁਲ ਤਾਂ ਹੀ ਮੈਂ ਮੈਨੂੰ ਮੈਂ ਪੁੱਛਿਆ ਸੀ ਕਿ ਆਪਣੇ ਭਰਾ ਨੂੰ ਉਹਨਾਂ ਨੇ ਕਿਹਾ ਸੀ ਕਿ ਭਾਅ ਜੀ ਨੂੰ ਨੌਲੇਜ ਹੈਗੀ ਆ ਇਹਦੇ ਬਾਰੇ ਨਾ ਅਤੇ ਇਹਨਾਂ ਨਾਲ ਤੁਸੀਂ ਇੱਕ ਵਾਰ ਗੱਲ ਕਰ ਲਿਓ ਮੈਂ ਤੁਹਾਨੂੰ ਤਾਂ ਹੀ ਘਰ ਗੱਲ ਕਰਨ ਆਇਆ ਸੀ ਇਹਦੇ ਬਾਰੇ ਕਿ ਅਸੀਂ ਇਹਦਾ ਇਸਤੇਮਾਲ ਕਰਦੇ ਆ ਇਸ ਵਾਰ ਫਸਲ 'ਚ ਠੀਕ ਹੈ ਜਦੋਂ ਤੁਸੀਂ ਮੈਨੂੰ ਘਰ ਆਓਗੇ ਤਾਂ ਮੈਨੂੰ ਫੋਨ ਕਰ ਦਿਓ ਇੱਕ ਮੈਂ ਤੁਹਾਨੂੰ ਮਿਲ ਲਵਾਂਗਾ ਬਹਿ ਕੇ ਗੱਲ ਕਰਦੇ ਠੀਕ ਹੈ ਜੀ ਓਕੇ